ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ੍ਹ ਵਿਗਿਆਨ ਨੇ ਬਹੁਤ ਹੀ ਵਧੀਆ ਤਰੱਕੀ ਕੀਤੀ ਹੈ ਅਤੇ ਇਹ ਤਰੱਕੀ ਹਰ ਖੇਤਰ ਵਿੱਚ ਕੀਤੀ ਗਈ ਹੈ ਜਿਸਦੀ ਸਹਾਇਤਾ ਨਾਲ ਹਰ ਇੱਕ ਕੰਮ ਬਹੁਤ ਹੀ ਆਸਾਨੀ ਨਾਲ ਹੋ ਜਾਂਦਾ ਹੈ ਅੱਜ ਕੱਲ੍ਹ ਪੜ੍ਹਾਈ ਵੀ ਔਨਲਾਈਨ ਹੋ ਰਹੀ ਹੈ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਆਡੀਓ ਬੁੱਕਸ ਦਾ ਵੀ ਇਹ ਇੱਕ ਵਿਕਲਪ ਸਾਡੇ ਕੋਲ ਹੈ ਜੋ ਕਿ ਵਿਗਿਆਨ ਦੀ ਇੱਕ ਬਹੁਤ ਵੱਡੀ ਦੇਣ ਹੈ ਆਡੀਓ ਬੁੱਕਸ ਰਾਹੀਂ ਅਸੀਂ ਕਿਤੇ ਵੀ ਕਿਸੇ ਵੀ ਜਗ੍ਹਾ ਕਿਤਾਬ ਨੂੰ ਸੁਣ ਸਕਦੇ ਹਨ ਜੋ ਕਿ ਸਾਡੇ ਲਈ ਬਹੁਤ ਹੀ ਫਾਇਦਾਮੰਦ ਹੈ ਕਿਉਂਕਿ ਕੁਝ ਲੋਕ ਐਸੇ ਹੁੰਦੇ ਹਨ ਜੋ ਕਿ ਪੜ੍ਹ ਨਹੀਂ ਸਕਦੇ ਸਿਰਫ ਸੁਣ ਸਕਦੇ ਹਨ ਇਹੋ ਤਰ੍ਹਾਂ ਆਡੀਓ ਬੁੱਕਸ ਦੇ ਰਾਹੀਂ ਉਹ ਕੋਈ ਵੀ ਕਿਤਾਬ ਜਾਂ ਕਹਾਣੀ ਆਸਾਨੀ ਨਾਲ ਸੁਣ ਸਕਦੇ ਹਨ ਧੰਨਵਾਦ